ਹੈਲੋ ਮੈਂ ਆਪਣੇ ਦੋਸਤ ਨਾਲ ਆਪਣੇ ਸੰਗੀਤ ਉਤਸਵ ਦੀਆਂ ਹੈਰਾਨੀਜਨਕ ਉਤਸ਼ਾਹ ਨੂੰ ਉਸਨੂੰ ਦੱਸਣਾ ਚਾਹੁੰਦੀ ਹਾਂ ਤੁਸੀਂ ਜਾਣਦੇ ਹੋ ਕੱਲ੍ਹ ਸੰਗੀਤ ਉਤਸਵ ਵਿੱਚ ਇਨ ਬਹੁਤ ਮਜ਼ਾ ਆਇਆ ਉੱਥੇ ਬਹੁਤ ਜ਼ਿਆਦਾ ਨਾਚ ਗਾਣਾ ਵੀ ਕੀਤਾ ਔਰ ਇਸ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਟਿਕਟ ਸਿਰਫ਼ ਚਾਰ ਸੌ ਰੁਪਏ ਹੈ ਔਰ ਉਸ ਵਿੱਚ ਖੇਡਣਾ ਖਾਣਾ ਪੀਣਾ ਨੱਚਣਾ ਗਾਉਣਾ ਹੋਰ ਵੀ ਬਹੁਤ ਕੁਛ ਉਪਲਬਧ ਸੀ ਇਸ ਵਿੱਚ ਇੰਨਾ ਮਜ਼ਾ ਆਇਆ ਤੁਸੀਂ ਵੀ ਅਗਰ ਨਾਲ ਜਾਂਦੇ ਤਾਂ ਬਹੁਤ ਮਜ਼ਾ ਆਉਣਾ ਸੀ ਔਰ ਇਸ ਦਾ ਬਜਟ ਵੀ ਬਹੁਤ ਸਸਤਾ ਹੈ